ਜਦੋਂ ਮੈਂ ਦਸ ਗਿਆਰ੍ਹਾਂ ਸਾਲ ਦੀ ਸੀ ਉਸ ਟਾਈਮ ਟੀ ਵੀ ਉੱਤੇ ਇੱਕ ਪ੍ਰੋਗਰਾਮ ਆਉਂਦਾ ਸੀ ਜਿਸ ਦਾ ਨਾਂ ਸਾਰੇ ਗਾਮਾ ਪਾ ਹੁੰਦਾ ਸੀ ਉਸ ਸ਼ੋਅ ਵਿੱਚ ਛੋਟੇ ਛੋਟੇ ਬੱਚੇ ਆਪਣੀ ਗਾਇਕੀ ਕਰੇ ਕਰਦੇ ਸਨ ਜਿਵੇਂ ਕਿ ਉਹ ਨਿਆਣੇ ਮੇਰੇ ਤੋਂ ਛੋਟੇ ਸੀ ਮੈਂ ਦਸ ਗਿਆਰ੍ਹਾਂ ਦੀ ਸੀ ਪਰ ਉਹ ਪੰਜ ਛੇ ਸਾਲਾਂ ਦੇ ਨਿਆਣੇ ਸੀ ਅਤੇ ਜਿਸ ਹਿਸਾਬ ਨਾਲ ਉਹ ਗਾਉਂਦੇ ਸੀ ਬਹੁਤ ਹੀ ਵਧੀਆ ਲੱਗਦੇ ਸੀ ਉਹਨਾਂ ਦੇ ਸਾਜ਼ ਉਹਨਾਂ ਦੇ ਸੁਰ ਬਹੁਤ ਹੀ ਵਧੀਆ ਜਾਂਦੇ ਸੀ ਮੈਨੂੰ ਦਸ ਗਿਆਰ੍ਹਾਂ ਸਾਲ ਦੀ ਉਮਰ ਤੋਂ ਬਾਅਦ ਗਾਉਣਾ ਵਧੀਆ ਲੱਗਣ ਲੱਗਾ ਜਿਵੇਂ ਜਿਵੇਂ ਉਹ ਨਿਆਣੇ ਗਾਉਂਦੇ ਮੈਂ ਉਹਨਾਂ ਦੇ ਗਾਣਿਆਂ ਨੂੰ ਕਾਪੀ ਕਰਕੇ ਆਪਣੇ ਘਰਦਿਆਂ ਨੂੰ ਸੁਣਾਉਂਦੀ ਅਤੇ ਆਪਣੇ ਵੱਲੋਂ ਸੁਰ ਲਾਉਣ ਦੀ ਕੋਸ਼ਿਸ਼ ਕਰਦੀ ਇੰਝ ਹੀ ਗਾਉਂਦਿਆਂ ਨੂੰ ਮੈਂ ਵਧੀਆ ਲੱਗਣ ਲੱਗੀ ਜਿਵੇਂ ਮੈਂ ਆਪਣੇ ਘਰਦਿਆਂ ਨੂੰ ਦੱਸਦੀ ਕਿ ਮੈਨੂੰ ਸਿੰਗਿੰਗ ਦਾ ਸ਼ੌਂਕ ਹੈ ਤਾਂ ਉਹਨਾਂ ਨੇ ਵੀ ਮੈਨੂੰ ਰੋਕਿਆ ਟੋਕਿਆ ਨਹੀਂ